ਹੈਲੋ ਸੈਣੀ ਟਰੈਵਲ ਏਜੰਸੀ ਸਰ ਅਸੀਂ ਨਾ ਤੁਹਾਨੂੰ ਡਰਾਇਵਰ ਬੁੱਕ ਕੀਤਾ ਸੀਗਾ ਸੋ ਅੱਜ ਸਾਡੀ ਤੜਕੇ ਚਾਰ ਵਜੇ ਦੀ ਸਰ ਅਸੀਂ ਜਾਣਾ ਸੀਗਾ ਨੈਣਾ ਦੇਵੀ ਜਾਣਾ ਸੀਗਾ ਔਰ ਅਸੀਂ ਕੈਬ ਬੁੱਕ ਕੀਤੀ ਹੋਈ ਸੀ ਸਰ ਮੈਂ ਡਰਾਇਵਰ ਨਾਲ ਗੱਲ ਵੀ ਕੀਤੀ ਸਾਰਾ ਕੁਝ ਸਾਡਾ ਫਿਕਸ ਹੋ ਗਿਆ ਸੀਗਾ ਮਗਰ ਉਹ ਹੁਣ ਤੱਕ ਆਇਆ ਨਹੀਂ ਸਾਡੀ ਬੁਕਿੰਗ ਹੋਈ ਹੋਈ ਸੀ ਵੀ ਅਸੀਂ ਪਹਿਲੇ ਨੈਣਾ ਦੇਵੀ ਤੜਕੇ ਚਾਰ ਵਜੇ ਯਾਤਰਾ 'ਤੇ ਜਾਣਾ ਉਸ ਤੋਂ ਬਾਅਦ ਫਿਰ ਸਰ ਅਸੀਂ ਸਾਰੀ ਫੈਮਿਲੀ ਨੇ ਸ਼ਿਮਲਾ ਜਾਣਾ ਸੀਗਾ ਕੱਲ੍ਹ ਤਾਂ ਸਾਰੀ ਸਰ ਬੁਕਿੰਗ ਵੀ ਹੋ ਗਈ ਸੀਗੀ ਸਾਰੀ ਅਮਾਉਂਟ ਦੀ ਗੱਲ ਵੀ ਹੋ ਗਈ ਮਗਰ ਸਰ ਦੇਖੋ ਹੁਣ ਤੱਕ ਮੋਰਨਿੰਗ ਦੇ ਪੰਜ ਵੱਜ ਚੁੱਕੇ ਨੇ ਲੇਕਿਨ ਕੋਈ ਡਰਾਇਵਰ ਸਾਡੇ ਕੋਲ ਤੁਹਾਡਾ ਨਹੀਂ ਪੁੱਜਿਆ ਔਰ ਸਰ ਈਵਨ ਅਸੀਂ ਕਾਲ ਵੀ ਕਰੀ ਜਾਂਦੇ ਹਾਂ ਸਾਡੀ ਕੋਈ ਕਾਲ ਵੀ ਨਹੀਂ ਚੱਕ ਰਿਹਾ ਆ ਇਹ ਤਾਂ ਸਰ ਤੁਸੀਂ ਦੱਸੋਂ ਗ਼ਲਤ ਗੱਲ ਨਹੀਂ ਹੈ ਵੀ ਤੁਹਾਡੀ ਆਪਣੀ ਇਮੇਜ ਵੀ ਖ਼ਰਾਬ ਹੋ ਰਹੀ ਹੈ ਹੈ ਅਸੀਂ ਟੈਂਸਨ ਹੋ ਰਹੇ ਹਾਂ ਸਾਡੇ ਘਰ ਦੇ ਵੀ ਆ ਨਾਲ ਦੇ ਵੀ ਸਾਰੇ ਲਾਗ ਪਾਸ ਵਾਲੇ ਦੇਖ ਰਹੇ ਆ ਸਾਰਿਆਂ ਨੂੰ ਪਤਾ ਆ ਵੀ ਕੀ ਬਣਨਾ ਸੀਗਾ ਅਸੀਂ ਜਾਣਾ ਸੀਗਾ ਹੁਣ ਬੇਜ਼ਇਤੀ ਤੁਹਾਡੀ ਵੀ ਹੈ ਤੁਸੀਂ ਇਹ ਤਾਂ ਦੇਖੋ ਆਪਣੀ ਤੁਸੀਂ ਇਮੇਜ ਬਣਾਉਈ ਹੈ ਕਿ ਨਹੀਂ ਇੱਜ਼ਤ ਤਾਂ ਖ਼ਰਾਬ ਹੁੰਦੀ ਹੈ ਨਾ ਹੁਣ ਸਰ ਜੀ ਤੁਸੀਂ ਜਾਂ ਤਾਂ ਸਾਡਾ ਹੀਲਾ ਕਰੋ ਸਾਨੂੰ ਨਹੀਂ ਪਤਾ ਸਾਡੇ ਕੋਲ ਤਾਂ ਅੱਜ ਦਾ ਹੀ ਦਿਨ ਆ ਤਾਂ ਕੱਲ੍ਹ ਦਾ ਦਿਨ ਘੁੰਮਣ ਨੂੰ ਹੁਣ ਤੁਸੀਂ ਦੱਸੋ ਸਾਡਾ ਟੈਮ ਖਰਾਬ ਹੋ ਰਿਹਾ ਇੰਨਾ ਸਾਡੇ ਟਾਇਮ ਦੀ ਬੁੱਕਤ ਕੋਈ ਹੈ ਹੈ ਤਾਂ ਸਾਡੇ ਫੈਮਿਲੀ ਵਾਲੇ ਵੀ ਖਰਾਬ ਹੋਈ ਜਾਂਦੇ ਦੁਖੀ ਹੋਈ ਜਾਂਦੇ ਆ ਮੈਨੂੰ ਗਾਲ੍ਹਾਂ ਅਲੱਗ ਪੈ ਰਹੀਆਂ ਤੁਹਾਨੂੰ ਹੁਣ ਮੈਂ ਦੱਸੋਂ ਮੈਂ ਤੁਹਾਡੇ ਨਾਲ ਕਿਵੇਂ ਕਰਾਂ ਕਿਵੇਂ ਨਿਜੱਠਾ ਮੇਰਾ ਕੋਈ ਹੱਲ ਕਰੋ ਮੈਨੂੰ ਨਹੀਂ ਪਤਾ ਮੇਰਾ ਹੀਲਾ ਤੁਸੀਂ ਓ ਕਰਨਾ ਹਾਂ ਠੀਕ ਹੈ ਜੀ ਹੁਣ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ ਡਰੈਵਰ ਭੇਜੋ ਨਹੀਂ ਤਾਂ ਸਰ ਜੀ ਮੈਨੂੰ ਫ਼ੌਨ 'ਤੇ ਡਰੈਵਰ ਨਾਲ ਗੱਲ ਕਰਵਾਓ ਜੀ